ਪੰਜਾਬੀ ਭਾਸ਼ਾ ਦੀ ਸਾਡੇ ਸੱਭਿਆਚਾਰਕ ਪੰਜਾਬ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਜੇਕਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਹੀ ਨਾ ਬੋਲੀ ਜਾਵੇ ਤਾਂ ਪੰਜਾਬ ਪੰਜਾਬ ਹੀ ਨਹੀਂ ਲੱਗਦਾ ਹੈਗਾ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਹੀ ਮੇਨ ਭਾਸ਼ਾ ਹੈ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਪੰਜਾਬ ਵਿੱਚ ਪੰਜਾਬੀ ਬੋਲੀ ਬਿਨਾਂ ਤਾਂ ਪੰਜਾਬ ਵਿੱਚ ਇੰਝ ਹੀ ਨਹੀਂ ਲੱਗਦਾ ਵੀ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਪੰਜਾਬ ਦੇ ਲੋਕ ਇੰਨੀ ਮਿੱਠੀ ਭਾਸ਼ਾ ਬੋਲਦੇ ਆ ਇੰਨਾ ਪਿਆਰ ਨਾਲ ਬੋਲਦੇ ਆ ਬੱਚਾ ਬੱਚਾ ਸਾਡਾ ਪੰਜਾਬ ਦਾ ਜੀ ਤੋਂ ਬਿਨਾਂ ਨਹੀਂ ਬੋਲਦਾ ਹੈਗਾ ਪੰਜਾਬੀ ਭਾਸ਼ਾ ਹੀ ਬੜੀ ਪਿਆਰੀ ਭਾਸ਼ਾ ਹੈ ਜਦੋਂ ਅਸੀਂ ਕਿਸੇ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਬੁਲਾਉਂਦੇ ਹਾਂ ਹਰੇਕ ਨੂੰ ਆਪਣੇ ਮਨ ਮੋਹ ਲੈਂਦੇ ਹਾਂ ਅਤੇ ਦੂਰੋਂ ਮਿਲਣ ਵਾਲੇ ਲੋਕ ਹਰਿਆਣੇ ਰਾਜਸਥਾਨ ਦੇ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ ਸਾਰੇ ਸਾਡੇ ਵੱਲ ਖਿੱਚੇ ਜਾਂਦੇ ਆ ਬੜਾ ਉਹਨਾਂ ਨੂੰ ਸਾਡੇ ਨਾਲ ਮੋਹ ਸਤਿਕਾਰ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਵਾਕਈ ਕਹਿ ਦਿੰਦੇ ਆ ਪੰਜਾਬ ਦੇ ਲੋਕ ਤਾਂ ਪੰਜਾਬੀ ਬੋਲ ਕੇ ਸਾਨੂੰ ਆਪਣੇ ਵੱਲ ਖਿੱਚ ਲੈਂਦੇ ਆ ਜਿੰਨਾ ਪੰਜਾਬੀ ਦੇ ਵਿੱਚ ਪਿਆਰ ਮੋਹ ਹੈ ਓਨਾਂ ਕਿਸੇ ਹੋਰ ਭਾਸ਼ਾ ਵਿੱਚ ਪੰਜਾਬ ਦੇ ਹੋਰ ਹੋਰ ਕਿਸੇ ਇਲਾਕੇ ਦੀ ਭਾਸ਼ਾ ਦੇ ਵਿੱਚ ਇੰਨਾ ਪਿਆਰ ਮੋਹ ਨਹੀਂ ਹੈਗਾ ਹੈਗਾ ਪੰਜਾਬ ਦੀ ਭਾਸ਼ਾ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਸਾਡਾ ਬੱਚਾ ਬੱਚਾ ਜੀ ਬੋਲਦਾ ਸਾਡੇ ਅਸੀਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ ਛੋਟਿਆਂ ਨਾਲ ਪਿਆਰ ਕਰਦੇ ਹਾਂ ਹਰੇਕ ਦਾ ਮਾਣ ਆਦਰ ਕਰਦੇ ਹਾਂ ਬਾਹਰ ਜਾਂਦੇ ਹਾਂ ਕਿਤੇ ਵੀ ਜਾਂਦੇ ਹਾਂ ਜਦੋਂ ਅਸੀਂ ਆਪਣੀ ਪੰਜਾਬੀ ਬੋਲਦੇ ਹਾਂ ਬੜਾ ਲੋਕ ਸਾਡੇ ਵੱਲ ਖਿੱਚੇ ਜਾਂਦੇ ਆ ਇਸ ਲਈ ਪੰਜਾਬੀ ਭਾਸ਼ਾ ਦਾ ਪੰਜਾਬ ਵਿੱਚ ਇੱਕ ਮੇਨ ਰੋਲ ਹੈ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਸਾਡੇ ਖਿਆਲ ਵਿੱਚ ਪੰਜਾਬੀ ਤੋਂ ਉੱਤੇ ਤਾਂ ਹੋਰ ਕੋਈ ਪਿਆਰੀ ਅਤੇ ਮਿੱਠੀ ਭਾਸ਼ਾ ਹੋ ਹੀ ਨਹੀਂ ਸਕਦੀ